ਮੇਰਾ ਨਾਮ ਮੋਨੀਕਾ ਹੈ ਅੱਜ ਮੈਂ ਤੁਹਾਨੂੰ ਬੱਚਿਆਂ ਦੇ ਮਨੋਰੰਜਨ ਬਾਰੇ ਦੱਸਣਾ ਚਾਹੁੰਦੀ ਹੈ ਅਤੇ ਉਹ ਖਾਲੀ ਸਮੇਂ ਵਿੱਚ ਕਿਆ ਕਰਦੇ ਹਨ ਉਸ ਬਾਰੇ ਵੀ ਤੁਹਾਨੂੰ ਸਾਰਿਆਂ ਨੂੰ ਥੋੜ੍ਹਾ ਬਹੁਤਾ ਸੁਝਾਅ ਦੇਣਾ ਚਾਹੁੰਦੀ ਹੈ ਬੱਚੇ ਅੱਜ ਕੱਲ ਜ਼ਿਆਦਾਤਰ ਫੋਨ ਦੇ ਵਿੱਚ ਹੀ ਰਹਿੰਦੇ ਹਨ ਪਹਿਲਾਂ ਦੇ ਬੱਚੇ ਸੀਗੇ ਜੋ ਕਿ ਫੋਨ ਤੋਂ ਦੂਰ ਰਹਿੰਦੇ ਸੀ ਨਾ ਕਿ ਉਹਨਾਂ ਨੂੰ ਫੋਨ ਵੀ ਨਹੀਂ ਮਿਲਦਾ ਸੀਗਾ ਉਹ ਜ਼ਿਆਦਾਤਰ ਬੱਚੇ ਕਬੱਡੀ ਖੋ ਖੋ ਬਾਂਟੇ ਆਦਿ ਗ ਗੇਮਾਂ ਖੇਡਦੇ ਸਨ ਅਤੇ ਅੱਜ ਕੱਲ ਜਦੋਂ ਦਾ ਫੋਨ ਆ ਗਿਆ ਹੈ ਜ਼ਿਆਦਾਤਰ ਬੱਚੇ ਫੋਨਾਂ ਦਾ ਹੀ ਇਸਤੇਮਾਲ ਕਰਦੇ ਹਨ ਫੋਨਾਂ 'ਚ ਹੀ ਚੌਵੀ ਘੰਟੇ ਬੜੇ ਰਹਿੰਦੇ ਹਨ ਆਪਣੇ ਖਾਣ ਪੀਣ ਦਾ ਵੀ ਨਹੀਂ ਧਿਆਨ ਰੱਖਦੇ ਇਸ ਨਾਲ ਸਾਨੂੰ ਬਹੁਤ ਹੀ ਬਿਮਾਰੀਆਂ ਲੱਗ ਜਾਂਦੀਆਂ ਹਨ ਜਿਵੇਂ ਕਿ ਅੱਖਾਂ ਖਰਾਬ ਹੋ ਜਾਂਦੀਆਂ ਹਨ ਦਿਮਾਗ ਪਰ ਅਸਰ ਵੀ ਹੋ ਜਾਂਦਾ ਏ ਅਤੇ ਹੋਰ ਵੀ ਕਈ ਪ੍ਰਕਾਰ ਦੀਆਂ ਬਿਮਾਰੀਆਂ ਦਾ ਸ਼ਿਕਾਰ ਹੋ ਕੇ ਇਸ ਨਾਲ ਮੌਤ ਵੀ ਹੋ ਜਾਂਦੀ ਹੈ ਜ਼ਿਆਦਾਤਰ ਬੱਚੇ ਅੱਖਾਂ ਮਰੋ ਫੋਨ ਨਹੀਂ ਛੱਡਦੇ ਫੋਨ ਦਾ ਫਾਇਦਾ ਵੀ ਹੈ ਨੁਕਸਾਨ ਵੀ ਹੈ ਜੇ ਬੱਚੇ ਜ਼ਿਆਦਾਤਰ ਫੋਨ 'ਚ ਸਹੀ ਗੱਲਾਂ ਦੇਖਦੇ ਉਹਨਾਂ ਨਾਲ ਉਹਨਾਂ ਨੂੰ ਫਾਇਦਾ ਵੀ ਹੋ ਜਾਂਦਾ ਏ ਅਤੇ ਅੱਜ ਕੱਲ ਫੋਨਾਂ ਵਿੱਚ ਗੇਮਾਂ ਖੇਡਣ ਨਾਲ ਬੱਚਿਆਂ ਦੇ ਦਿਮਾਗ 'ਤੇ ਅਸਰ ਪੈਂਦਾ ਏ ਅਤੇ ਉਹ ਫੋਨ ਨੂੰ ਕਦੇ ਵੀ ਆਪਣੇ ਤੋਂ ਦੂਰ ਨਹੀਂ ਛੱਡਦੇ ਇਸ ਨਾਲ ਬੱਚਿਆਂ ਨੂੰ ਘੱਟ ਤੋਂ ਘੱਟ ਸਾਰੇ ਏ ਜਾਣੇ ਫੋਨ ਘੱਟ ਤੋਂ ਘੱਟ ਦਿੱਤਾ ਜਾਵੇ